ਹਾਂਜੀ ਮੈਨੂੰ ਬਿਲਕੁਲ ਪਾਣੀ ਦੀ ਕਮੀ ਹੋਣ ਦੀ ਅੱਗੇ ਆਉਣ ਵਾਲੇ ਸਮੇਂ 'ਚ ਉਮੀਦ ਹੈ ਜਿੱਦਾਂ ਕਿ ਸੁਣਦੇ ਆ ਰਹੇ ਹਾਂ ਪਾਣੀ ਹਰ ਜਗ੍ਹਾ ਧਰਤੀ ਦੇ ਲੈਵਲ 'ਚ ਵੀ ਘੱਟਦਾ ਜਾ ਰਿਹਾ ਹੈ ਇਹ ਕਈ ਜਗਾਵਾਂ 'ਤੇ ਵੀ ਤਾਂ ਖ਼ਤਮ ਵੀ ਹੋ ਗਿਆ ਹੈ ਦੇਸ਼ ਵਿੱਚ ਸਾਡੇ ਪੰਜਾਬ ਰਾਜ 'ਚ ਹਜੇ ਫਿਰ ਵੀ ਖ਼ਤਮ ਤਾਂ ਨਹੀਂ ਹੋਇਆ ਹੈ ਬਟ ਉਹਦਾ ਲੈਵਲ ਕਾਫ਼ੀ ਥੱਲੇ ਜਾ ਚੁੱਕਿਆ ਹੈ ਸੋ ਮੈਂ ਆਰਕੀਟੈਕਟ ਹੋ ਕੇ ਐਟਲੀਸਟ ਜਿੰਨਾ ਕਰ ਸਕਦਾ ਉਹ ਤਾਂ ਕਰਦਾ ਹੀ ਹਾਂ ਕਿ ਅਸੀਂ ਜਿਹੜੇ ਹਰ ਆਪਣੇ ਆਪਣੇ ਘਰਾਂ 'ਚ ਲੋਕੀ ਬੋਰ ਕਰਾਉਂਦੇ ਹਨ ਨੂੰ ਨਾ ਕਰਨ ਦਾ ਜ਼ਰੂਰ ਪ੍ਰਪੋਜਲ ਦੇਈਦਾ ਹੈ ਕਹੀ ਦਾ ਹੈ ਕਈ ਲੋਕ ਮੰਨਦੇ ਵੀ ਹਨ ਕਈ ਨਹੀਂ ਵੀ ਮੰਨਦੇ ਹਨ ਬਾਕੀ ਜਿੰਨਾ ਵੀ ਸਾਡਾ ਬਾਰਿਸ਼ ਦਾ ਪਾਣੀ ਹੁੰਦਾ ਹੈ ਜਿਹੜਾ ਛੱਤ ਹੋ ਗਈ ਬਾਲਕਨੀ ਹੋ ਗਈ ਜਿੱਥੋਂ ਵੀ ਇਕੱਠਾ ਹੁੰਦਾ ਹੈ ਉਹਦੀ ਅਸੀਂ ਪਲੰਮਿੰਗ ਦੀਆਂ ਪਾਈਪਾਂ ਅਲੱਗ ਤੋਂ ਦਬਾਉਂਦੇ ਹਾਂ ਤਾਂ ਕਿ ਉਹ ਸਾਰਾ ਪਾਣੀ ਸੀਵਰ 'ਚ ਨਾ ਜਾ ਕੇ ਅਲੱਗ ਤੋਂ ਇਕੱਠਾ ਹੋ ਕੇ ਵਾਪਿਸ ਰਿਚਾਰਜ ਕੀਤਾ ਜਾਏ ਵਾਪਿਸ ਧਰਤੀ ਦੇ ਵਿੱਚ ਸੁੱਟਿਆ ਜਾਏ ਅਤੇ ਉਹਦੇ ਲਈ ਅਸੀਂ ਇੱਕ ਬੋਰ ਕਰਾਉਂਦੇ ਹਾਂ ਜੋ ਕਿ ਇਹ ਸਾਰੇ ਸਾਫ਼ ਪਾਣੀ ਨੂੰ ਅਲੱਗ ਤੋਂ ਵਾਪਿਸ ਧਰਤੀ ਦੇ ਵਿੱਚ ਰਿਚਾਰਜ ਕਰਦਾ ਹੈ ਇਹ ਪ੍ਰੈਕਟਿਸ ਵੈਸੇ ਹੁਣ ਕਾਫ਼ੀ ਨੋਰਮਲ ਕੋਮਨ ਹੋ ਗਈ ਹੈ ਕਾਫ਼ੀ ਲੋਕ ਕਰਾ ਰਹੇ ਹਨ ਬਾਕੀ ਜਿੰਨਾ ਵੀ ਏ ਸੀ ਹੋ ਗਏ ਏ ਸੀ ਤੋਂ ਪਾਣੀ ਜਿਹੜਾ ਵੇਸਟ ਨਿਕਲਦਾ ਹੈ ਕੰਡਨਸੇਸ਼ਨ ਦਾ ਆਰ ਓ ਹੋ ਗਏ ਇਹਨਾਂ ਪਾਣੀ ਦੀ ਜਿਹੜੀ ਵੀ ਵੇਸਟੇਜ ਨਿਕਲਦੀ ਹੈ ਉਹ ਵੀ ਅਸੀਂ ਸੀਵਰ 'ਚ ਨਾ ਸੁੱਟ ਕੇ ਉਹਨੂੰ ਵੀ ਕਿਸੇ ਤਰ੍ਹਾਂ ਕਸਟਮਾਈਸ ਪਾਈਪ ਲਾਈਨਸ ਦੇ ਥਰੂ ਪੌਂਦਿਆਂ ਨੂੰ ਲੈਂਡਸਕੇਪਿੰਗ ਨੂੰ ਡ ਡਰੈਕਟ ਕਰ ਦਿੰਦੇ ਹਾਂ ਜਾਂ ਫਿਰ ਕਿਤੇ ਨਾ ਕਿਤੇ ਸਟੋਰ ਕਰਦੇ ਹਾਂ ਤਾਂ ਕਿ ਇਹ ਵੀ ਫਿਰ ਤੋਂ ਇਸਤੇਮਾਲ ਹੋ ਸਕੇ ਵੇਸਟ ਨਾ ਜਾਏ ਜਾਇਆ ਨਾ ਜਾਏ ਬਾਕੀ ਕਈ ਕੰਸਟ੍ਰਕਸ਼ਨ ਦੀਆਂ ਤਕਨੀਕਾਂ ਹਨ ਜਿਹੜੀਆਂ ਆਪਾਂ ਅਜਿਹੀਆਂ ਇਸਤੇਮਾਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰੀਦੀ ਹੈ ਕਿ ਪਾਣੀ ਦੀ ਕੰਸਟ੍ਰਕਸ਼ਨ ਜਿਹੜੀ ਜ਼ਰੂਰਤ ਹੁੰਦੀ ਉਹ ਵੀ ਘੱਟ ਤੋਂ ਘੱਟ ਹੋਵੇ ਜਿਵੇਂ ਇੱਟਾਂ ਦੀਆਂ ਦੀਵਾਰਾਂ ਬਣਦੀਆਂ ਹਨ ਉਹਦੇ ਉੱਤੇ ਫਿਰ ਕਿੰਨੀ ਤਰਾਈ ਕੀਤੀ ਜਾਂਦੀ ਹੈ ਫਿਰ ਪਲਸਤਰ ਹੁੰਦਾ ਹੈ ਉਹ ਪਲਸਤਰ ਦੇ ਉੱਤੇ ਤਰਾਈ ਕੀਤੀ ਜਾਂਦੀ ਹੈ ਫਿਰ ਉਹਨੂੰ ਸੁਕਾਇਆਂ ਜਾਂਦਾ ਹੈ ਫਿਰ ਪੇਂਟ ਹੁੰਦਾ ਹੈ ਅਸੀਂ ਪੇਂਟ ਪਲਸਤਰ ਹਟਾ ਕੇ ਸਾਫ਼ ਇੱਟਾਂ ਦੀਆਂ ਹੀ ਸਾਫ਼ ਦੀਵਾਰਾਂ ਜੋ ਬਣਾਉਂਦੇ ਹਾਂ ਆਪਣੇ ਪ੍ਰੋਜੈਕਟਸ ਵਿੱਚ ਤਾਂ ਕਿ ਮਟੀਰੀਅਲ ਤਾਂ ਬਚੇ ਬਟ ਉਹਦੇ ਨਾਲ ਪਾਣੀ ਵੀ ਕਾਫ਼ੀ ਬਚਦਾ ਹੈ